ਦਸਤ ਇੱਕ ਅਜਿਹਾ ਰੋਗ ਹੈ ਜਿਸ ਨੂੰ ਠੀਕ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਇੱਕ ਬਹੁਤ ਹੀ ਭੈੜੀ ਬਿਮਾਰੀ ਹੈ ਦਸਤ ਦਾ ਇਲਾਜ ਲਈ ਸਾਡੇ ਪਿੰਡ ਵਿੱਚ ਬਹੁਤ ਸਾਰੇ ਘਰੇਲੂ ਨੁਕਤੇ ਪ੍ਰਸਿੱਧ ਹਨ ਜਿਵੇਂ ਕਿ ਲੋਕ ਕਈ ਵਗੈਰਾ ਕੇਲੇ ਵਗੈਰਾ ਖਾ ਲੈਂਦੇ ਹਨ ਜਿਸ ਦੇ ਨਾਲ ਦਸਤ ਦਾ ਇਲਾਜ ਹੋ ਸਕਦਾ ਹੈ ਅਤੇ ਇਸ ਦੇ ਰਾਹੀਂ ਅਗਰ ਜੇਕਰ ਤਾਂ ਵੀ ਤੁਹਾਡੀ ਦਸਤ ਦਾ ਇਲਾਜ ਨਹੀਂ ਹੁੰਦਾ ਹੈ ਤਾਂ ਤੁਸੀਂ ਆਪਣੇ ਨਿੱਜੀ ਹਸਪਤਾਲ ਜਾ ਕੇ ਅੱਛੇ ਤਰੀਕੇ ਨਾਲ ਟ੍ਰੀਟਮੈਂਟ ਕਰਾ ਸਕਦੇ ਹਨ ਅਤੇ ਚੰਗੀਆਂ ਦਵਾਈਆਂ ਖਾ ਕੇ ਫਿਰ ਤੁਹਾਡੇ ਦਸਤ ਦਾ ਇਲਾਜ ਹੋ ਜਾਂਦਾ ਹੈ